ਮੈਨੂੰ ਹਾਈਕ ਕਰਨ ਲਈ ਜ਼ਿਆਦਾਤਰ ਪਹਾੜੀ ਇਲਾਕਾ ਪਸੰਦ ਹੈ ਮੈਨੂੰ ਪੱਕੇ ਪਹਾੜ ਵੀ ਪਸੰਦ ਹਨ ਮੈਨੂੰ ਕੱਚੇ ਪਹਾੜ ਵੀ ਟਰਨਲਜ ਗੁਫਾਵਾਂ ਵਿੱਚ ਲੰਘਣਾ ਮੈਨੂੰ ਬਹੁਤ ਅੱਛਾ ਲੱਗਦਾ ਮੈਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਰਹਿੰਦੀ ਹਾਂ ਸਾਨੂੰ ਜ਼ਿਆਦਾਤਰ ਜੰਮੂ ਕਸ਼ਮੀਰ ਅਤੇ ਹਿਮਾਚਲ ਪਹਾੜੀ ਇਲਾਕਾ ਲੱਗਦੇ ਹਨ ਜੰਮੂ ਕਸ਼ਮੀਰ ਤਾਂ ਅਸੀਂ ਬਹੁਤ ਘੱਟ ਗਏ ਹਾਂ ਪਰ ਹਿਮਾਚਲ ਅਸੀਂ ਜਾਂਦੇ ਰਹਿੰਦੇ ਹਾਂ ਹਿਮਾਚਲ ਪ੍ਰਦੇਸ਼ ਵਿੱਚ ਪਹਾੜਾਂ ਦਾ ਵਿਊ ਬਹੁਤ ਵਧੀਆ ਹੁੰਦਾ ਹੈ ਜਿਵੇਂ ਕਿ ਸਾਡੇ ਕੋਲਜ ਦਾ ਟੂਰ ਹੀ ਹਿਮਾਚਲ ਪ੍ਰਦੇਸ਼ ਗਿਆ ਸੀ ਉੱਥੇ ਪਹਾੜ ਦੇਖ ਕੇ ਸਾਨੂੰ ਬਹੁਤ ਅੱਛਾ ਲੱਗਿਆ ਉੱਥੋਂ ਦਾ ਸੂਰਜ ਨੂੰ ਚੜ੍ਹਨਾ ਉਹਦੀਆਂ ਕਿਰਨਾਂ ਬਹੁਤ ਅੱਛਾ ਲੱਗਦਾ ਹੈ ਉੱਥੋਂ ਦਾ ਮਾਹੌਲ ਉੱਥੋਂ ਦੀਆਂ ਸ਼ਾਂਤੀ ਜੋ ਕਿ ਕੁਦਰਤ ਨੂੰ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਹੈ ਜੋ ਕਿ ਬਹੁਤ ਹੀ ਵਧੀਆ ਲੱਗਦਾ ਹੈ ਉੱਥੋਂ ਦਾ ਸ਼ਾਂਤ ਮਾਹੌਲ ਬਹੁਤ ਵਧੀਆ ਕੁਦਰਤ ਨੂੰ ਪ੍ਰਦਰਸ਼ਨ ਕਰਦਾ ਹੈ ਧੰਨਵਾਦ